ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਭਾਸ਼ਾ ਹੈ ਇਹ ਸਾਰੇ ਦੇਸ਼ਾਂ ਵਿੱਚ ਹੀ ਬੋਲੀ ਜਾਂਦੀ ਹੈ ਪੰਜਾਬੀ ਬੋਲਣ ਵਿੱਚ ਕਿਸੇ ਨੂੰ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਇਹ ਪੰਜਾਬੀ ਭਾਸ਼ਾ ਬਹੁਤ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਹੋਈ ਹੈ ਅਮਰੀਕਾ ਕਨੇਡਾ ਵਿੱਚ ਵੀ ਬਹੁਤ ਸਾਰੇ ਪੰਜਾਬੀ ਜਾ ਕੇ ਵਸੇ ਹੋਏ ਹਨ ਬਹੁਤ ਘੱਟ ਲੋਕ ਹਨ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਪੰਜਾਬੀ ਸਾਡੀ ਮਾਂ ਬੋਲੀ ਹੈ ਪੰਜਾਬੀ ਬਹੁਤ ਹੀ ਭਾਸ਼ਾ ਹੈ ਪੰਜਾਬੀ ਬੋਲਣ ਵਿੱਚ ਕੋਈ ਵੀ ਝਿਜਕਾਉਂਦਾ ਨਹੀਂ ਹੈ ਪੰਜਾਬੀ ਬਹੁਤ ਹੀ ਵਧੀਆ ਹੈ ਪੰਜਾਬੀ ਭਾਸ਼ਾ ਸਾਡੀ ਗੁਰਮੁਖੀ ਲਿਪੀ ਹੈ ਪੰਜਾਬੀ